ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਐਮਾਜੋਨ ਕੰਪਨੀ ਤੋਂ ਗੱਲ ਕਰ ਰਹੇ ਹੋ ਮੈਂ ਰਮਨਦੀਪ ਕੌਰ ਝੁੰਬੇ ਤੋਂ ਮੈਂ ਤੁਹਾਡੇ ਤੋਂ ਔਨਲਾਈਨ ਐ ਔਨਲਾਈਨ ਹੈੱਡਫੋਨ ਮੰਗਵਾਏ ਸੀ ਜੋ ਬਹੁਤ ਹੀ ਵਧੀਆ ਹਨ ਕਿਉਂਕਿ ਮੈਂ ਪਹਿਲਾਂ ਵੀ ਇਹ ਹੈੱਡਫੋਨ ਮਤਲਬ ਔਨਲਾਈਨ ਕੀਤੇ ਹੋਏ ਸੀ ਜੋ ਮੈਨੂੰ ਬਹੁਤ ਹੀ ਖਰਾਬ ਨਿਕਲੇ ਜਿਸ ਕਰਕੇ ਮੈਨੂੰ ਡਰ ਸੀ ਜਿੰਨਾ ਟਾਈਮ ਵੀ ਮੇਰੇ ਕੋਲ ਤੁਹਾਡੇ ਏ ਏਅਰਫੋਨ ਹੈੱਡਫੋਨ ਨਹੀਂ ਆਉਂਦੇ ਓਨਾਂ ਟਾਈਮ ਕਿਤੇ ਮੇਰੇ ਪੈਸੇ ਨਾ ਡੁੱਬ ਜਾਣ ਬਟ ਤੁਹਾਡੇ ਹੈੱਡਫੋਨ ਬਹੁਤ ਹੀ ਵਧੀਆ ਸੀ ਅਤੇ ਮੈਂ ਕਾਲੇ ਰੰਗ ਦੇ ਲਏ ਨੇ ਵਾਇਰ ਵਾਲੇ ਜਿਹਨਾਂ ਦੀ ਵੋਲਿਊਮ ਬਹੁਤ ਹੀ ਵਧੀਆ ਹੈ ਅਤੇ ਜਦੋਂ ਵੀ ਮੈਂ ਉਹਨਾਂ ਨੂੰ ਲਾ ਕੇ ਸੁਣਦੀ ਹਾਂ ਮੈਨੂੰ ਬਹੁਤ ਹੀ ਰਿਲੈਕਸ ਫੀਲ ਹੁੰਦਾ ਮੈਂ ਆਪਣੇ ਫਰੈਂਡਾਂ ਨੂੰ ਵੀ ਦਿਖਾਇਆ ਅਤੇ ਉਹ ਕਹਿੰਦੇ ਇਹ ਤਾਂ ਬਹੁਤ ਹੀ ਵਧੀਆ ਚੀਜ਼ ਹੈ ਉਹ ਮੈਨੂੰ ਕਹਿੰਦੇ ਵੀ ਤੂੰ ਕਿੱਥੋਂ ਮੰਗਵਾਏ ਹੈ ਮੈਂ ਕਿਹਾ ਮੈਂ ਐਮਾਜੋਨ ਤੋਂ ਮੰਗਵਾਏ ਹੈ ਅਤੇ ਉਹ ਕਹਿੰਦੇ ਅਸੀਂ ਵੀ ਮੰਗਵਾਵਾਂਗੇ ਤੁਹਾਡੇ ਪੋ ਤੁਹਾਡੀ ਮੰਗਾਈ ਹੋਈ ਔਨਲਾਈਨ ਚੀਜ਼ ਮੈਨੂੰ ਬਹੁਤ ਬਹੁਤ ਪਸੰਦ ਆਈ ਇਸ ਕਰਕੇ ਮੈਂ ਅੱਗੇ ਤੋਂ ਵੀ ਤੁਹਾਡੇ ਤੋਂ ਹਰ ਇੱਕ ਚੀਜ਼ ਐਮਾਜੋਨ ਤੋਂ ਮੰਗਾਉਂਦੀ ਰਹਾਂਗੀ ਤੁਹਾਡੀ ਹਰ ਇੱਕ ਚੀਜ਼ ਬਹੁਤ ਹੀ ਵਧੀਆ ਅਤੇ ਇੱਕ ਬਹੁਤ ਹੀ ਇੱਕ ਨੰਬਰ ਹੁੰਦੀ ਹੈ ਐਂਡ ਥੈਂਕ ਯੂ ਵੀਰ ਜੀ